ਯੂਅਰ ਕਾਲ ਇਜ਼ ਨਾਉ ਬੀਂਗ ਰਿਕਾਰਡ ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਡਮ ਤੁਸੀਂ ਹੋਵਲੇਨ ਸੀਨੀਅਰ ਸਕੂਲ ਤੋਂ ਬੋਲਦੇ ਹੋ ਹਾਂਜੀ ਮੈਂ ਏਕਮਦੀਪ ਸਿੰਘ ਕਲਾਸ ਸਿਕਸ ਅਤੇ ਉਹਨਾਂ ਦੀ ਮਦਰ ਬੋਲਦੀ ਹਾਂ ਹਾਂਜੀ ਮੈਡਮ ਅਸੀਂ ਨਾ ਮੈਰਿਜ 'ਤੇ ਜਾਣਾ ਸੀਗਾ ਸਾਨੂੰ ਦਸ ਦਿਨ ਦੀ ਛੁੱਟੀ ਚਾਹੀਦੀ ਹੈ ਨਹੀਂ ਮੈਡਮ ਮੇਰੇ ਬ੍ਰਦਰ ਦੀ ਮੈਰਿਜ ਆ ਅਤੇ ਮੇਰਾ ਜਾਣਾ ਬਹੁਤ ਜ਼ਰੂਰੀ ਆ ਇ ਇਹਦਾ ਸਕੂਲ ਆਉਣਾ ਬਹੁਤ ਮੁਸ਼ਕਿਲ ਆ ਨਹੀਂ ਮੈਡਮ ਇਹਨੂੰ ਤਿਆਰ ਕਰਕੇ ਸਕੂਲ ਭੇਜਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਇਸ ਕਰਕੇ ਤੁਸੀਂ ਲੀਵ ਦੇ ਸਕਦੇ ਹੋ ਹਾਂ ਮੈਡਮ ਉਹ ਗੱਲ ਤਾਂ ਠੀਕ ਆ ਬਟ ਮੈਡਮ ਘਰ ਥੋੜ੍ਹੀ ਯਾਨੀ ਕਿ ਬੱਚੇ ਨੂੰ ਤਿਆਰ ਵਗੈਰਾ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਇਹਨੇ ਸਟੱਡੀ ਵਗੈਰਾ ਨਹੀਂ ਕਰਨੀ ਹੈ ਨਾ ਅਤੇ ਮੈਡਮ ਤੁਸੀ ਹਾਂਜੀ ਹਾਂ ਮੈਡਮ ਅਸੀਂ ਨਾ ਕਾਫੀ ਦੂਰ ਜਾਣਾ ਸੀਗਾ ਮੇਰੇ ਯਾਨੀ ਕਿ ਪੇਕੇ ਕਾਫੀ ਦੂਰ ਆ ਇਸ ਕਰਕੇ ਹਾਂਜੀ ਕਿਉਂਕਿ ਐਡੀ ਦੂਰ ਤੋਂ

ਚਲੋ ਮੈਡਮ ਤੁਸੀਂ ਪੰਜ ਦਿਨ ਦੀ ਕਰ ਸਕਦੇ ਹੋ ਹਾਫ਼ ਕਰ ਦਿਉ ਨਾ ਹਾਂਜੀ ਮੈਡਮ ਹਾਂਜੀ ਠੀਕ ਆ ਥੈਂਕ ਯੂ ਮੈਮ